ਹੈਲੋ ਹਾਂਜੀ ਗਮਲੇ ਅੱਛਾ ਕਿਸ ਤਰ੍ਹਾਂ ਦੇ ਲੈਣੇ ਹੈ ਤੁਸੀਂ ਸਾਡੇ ਕੋਲ ਤਾਂ ਹਰੇਕ ਤਰ੍ਹਾਂ ਦਾ ਬੂਟਾ ਅੱਛਾ ਬਾਹਰ ਲਾਣ ਵਾਸਤੇ ਵੀ ਮਿਲ ਜਾਣਗੇ ਅਤੇ ਅੰਦਰ ਲਾਣ ਵਾਸਤੇ ਵੀ ਜਿਹੜੇ ਬਾਹਰ ਬੂਟੇ ਲੱਗਣਗੇ ਉਹਨਾਂ ਨੂੰ ਥੋੜ੍ਹਾ ਪਾਣੀ ਜ਼ਿਆਦਾ ਦੇਣਾ ਪੈਣਾ ਅਤੇ ਮਤਲਬ ਜਿਹੜੀ ਕੇਅਰ ਹੈ ਥੋੜ੍ਹੀ ਵੱਧ ਕਰਨੀ ਪੈਣੀ ਏ ਉਹਨਾਂ ਨੂੰ ਛਾਂ ਦੇ ਕੇ ਰੱਖਣੀ ਧੁੱਪ ਤੋਂ ਬਚਾ ਕੇ ਰੱਖਣਾ ਬਾਕੀ ਤੁਸੀਂ ਜਿਹੜੇ ਵੀ ਪਸੰਦ ਨੇ ਤੁਹਾਨੂੰ ਬੂਟੇ ਮਤਲਬ ਕਿ ਇੱਥੇ ਆ ਕੇ ਦੇਖ ਲਿਓ ਜਾਂ ਫਿਰ ਜਿਹੜੇ ਤੁਸੀਂ ਸੋਚੇ ਹੋਏ ਨੇ ਪਹਿਲਾਂ ਤਾਂ ਉਹ ਵੀ ਦੱਸ ਦਿਓ ਤੁਹਾਨੂੰ ਹਰੇਕ ਤਰ੍ਹਾਂ ਦਾ ਬੂਟਾ ਮਿਲ ਜੂਗਾ ਇੱਥੋਂ ਠੀਕ ਆ ਗਮਲੇ ਵੀ ਸਾਡੇ ਕੋਲ ਮਿੱਟੀ ਦੇ ਵੀ ਹੈ ਪਲਾਸਟਿਕ ਦੇ ਵੀ ਹੈ ਅਤੇ ਚੀਨੀ ਦੇ ਵੀ ਤੁਸੀਂ ਕਿਹੜੇ ਲੈਣੇ ਨੇ ਮਿੱਟੀ ਦੇ ਚਲੋ ਠੀਕ ਹੈ ਕਿੰਨੇ ਲੈਣੇ ਤੁਸੀਂ ਠੀਕ ਹੈ ਠੀਕ ਹੈ ਜੀ ਗਮਲੇ ਵਾਸਤੇ ਸਟੈਂਡ ਉਹ ਵੀ ਮਿਲ ਜਾਏਗਾ ਬਾਕੀ ਤੁਸੀਂ ਡਿਜ਼ਾਇਨ ਦੇ ਹਿਸਾਬ ਨਾਲ ਇੱਥੇ ਆ ਕੇ ਦੇਖ ਲਿਓ ਹਾਂਜੀ ਠੀ ਬਾਕੀ ਜਿਹੜੀ ਤੁਹਾਨੂੰ ਪਸੰਦ ਹੋਵੇ ਉਹ ਦੇਖ ਲਿਓ ਹਾਂ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਜੀ ਠੀਕ